ਪਿਛਲੇ ਕੁਝ ਦਹਾਕਿਆਂ ਦੌਰਾਨ ਨੌਜਵਾਨ ਆਪਣੇ ਵਿਰਸੇ ਦੇ ਕੰਮ ਜਾਂ ਆਪਣੇ ਹੱਥੀਂ ਕੰਮ ਕਰਨਾ ਦਾ ਚੰਗਾ ਸਮਝਦੇ ਸੀ ਜੋ ਉਹਨਾਂ ਦੇ ਦਾਦੇ ਪੜਦਾਦੇ ਕਰਦੇ ਸਨ ਉਹ ਵੀ ਉਹਨਾਂ ਵਿੱਚ ਰੁਚੀ ਲੈਣ ਲੱਗ ਪੈਂਦੇ ਸਨ ਅਤੇ ਉਹਨਾਂ ਨੂੰ ਹੀ ਉਹ ਆਪਣਾ ਗਾਂਹ ਰੁਜ਼ਗਾਰ ਬਣਾਉਂਦੇ ਸੀ ਉਨ ਅਤੇ ਪਰ ਅੱਜ ਹੁਣ ਯੁੱਗ ਦੇ ਵਿੱਚ ਬਦਲ ਜ਼ਿੰਦਗੀ ਦੇ ਵਿੱਚ ਨੌਜਵਾਨਾਂ ਦੀ ਜ਼ਿੰਦਗੀ ਥੋੜ੍ਹੀ ਬਦਲ ਗਈ ਹੈ ਯੂਟਿਊਬ ਦੇ ਵਿੱਚ ਨੌਜਵਾਨ ਕਈ ਵਲੋਗ ਬਣਾਉਂਦੇ ਹਨ ਘਰ ਬੈਠੇ ਹੀ ਉਹਨਾਂ ਨੂੰ ਲਾਈਕ ਜਾਂ ਸਬਸਕ੍ਰਾਈਬ ਦੇ ਹਿਸਾਬ ਨਾਲ ਪੈਸੇ ਘਰ ਬੈਠੇ ਹੀ ਮਿਲ ਜਾਂਦੇ ਹਨ ਅਤੇ ਇੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਨੌਜਵਾਨਾਂ ਨੂੰ ਇੱਕ ਨਵਾਂ ਇੱਕ ਨਵਾਂ ਫੀਲਡ ਮਿਲ ਗਿਆ ਹੈ ਨਵਾਂ ਪਲੇਟਫਾਰਮ ਮਿਲ ਗਿਆ ਵੈ ਜਿਹਦੇ ਵਿੱਚ ਨੌਜਵਾਨ ਇੱਕ ਆਪਣੀ ਮਨ ਪਸੰਦ ਦੇ ਅਤੇ ਇੱਕ ਜਾਂ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਉਹ ਆਪਣੀ ਮਨ ਪਸੰਦ ਅਤੇ ਆਪਣੇ ਰੁਚੀ ਦੇ ਅਨੁਸਾਰ ਕੰਮ ਕਰ ਸਕਦੇ ਹਨ ਜੋ ਕਿ ਇੱਕ ਸਾਇੰਸ ਦੀ ਇੱਕ ਦੇਣ ਹੈ